ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਰੱਖਦੇ ਵੀ ਨੇ ਅਤੇ ਮੈਂ ਵੀ ਆਪਣੀ ਸਿਹਤ ਦਾ ਧਿਆਨ ਰੱਖਦੀ ਹਾਂ ਅਤੇ ਮੈਂ ਵੀ ਮੋਰਨਿੰਗ ਵੋਕ ਲਈ ਜਾਂ ਈਵਨਿੰਗ ਵੋਕ ਲਈ ਜਾਂਦੀ ਰਹਿੰਦੀ ਹਾਂ ਅਤੇ ਜਦ ਵੀ ਮੈਨੂੰ ਸਮਾਂ ਲੱਗਦਾ ਹੈ ਮੈਂ ਥੋ ਚਾਹੇ ਥੋੜ੍ਹੀ ਦੇਰ ਲਈ ਹੀ ਜਾਵਾਂ ਮੈਂ ਉੱਥੇ ਜ਼ਰੂਰ ਜਾਂਦੀ ਹਾਂ ਮੇਰੇ ਘਰ ਦੇ ਨੇੜੇ ਹੀ ਇੱਕ ਪਾਰਕ ਹੈਗਾ ਹੈ ਉੱਥੇ ਰਨਿੰਗ ਵਾਸਤੇ ਬਹੁਤ ਹੀ ਅੱਛੀ ਜਗ੍ਹਾ ਬਣੀ ਹੋਈ ਹੈ ਅਤੇ ਉੱਥੇ ਕਾਫ਼ੀ ਲੋਕ ਜਿਹੜੇ ਨੇ ਉਹ ਆਉਂਦੇ ਨੇ ਅਤੇ ਆਪਣੀ ਯੋਗਾ ਅਤੇ ਆਪਣੀ ਜਿਹੜੀ ਰਨਿੰਗ ਹੈ ਉਹ ਕਰਦੇ ਨੇ ਅਤੇ ਮੈਂ